ਸਰਕਾਰ ਨੇ ਨੌਜਵਾਨਾਂ ਲਈ ਰੋਜ਼ਗਾਰ ਸਹੂਲਤਾਂ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਹਨ ਅੱਜ ਦੇ ਟਾਈਮ ਵਿੱਚ ਬਹੁਤ ਨੌਜਵਾਨ ਸਰਕਾਰੀ ਨੌਕਰੀ ਲੱਗ ਚੁੱਕੇ ਹਨ ਜਦੋਂ ਦੀ ਦੋ ਹਜ਼ਾਰ ਬਾਈ ਵਿੱਚ ਆਮ ਆਦਮੀ ਪਾਰਟੀ ਆਈ ਹੈ ਤਾਂ ਕਈ ਨੌਜਵਾਨ ਨੌਕਰੀ ਲੱਗ ਚੁੱਕੇ ਹਨ ਅਤੇ ਆਪਣਾ ਰੋਜ਼ਗਾਰ ਕਰਦੇ ਸਨ ਉਹ ਆਪਣੀ ਰੋਜ਼ੀ ਰੋਟੀ ਲਈ ਸਰਕਾਰੀ ਨੌਕਰੀ ਲੱਭਦੇ ਹਨ ਜਿਸ ਕਰਕੇ ਆਮ ਆਦਮੀ ਪਾਰਟੀ ਨੇ ਕਈ ਤਰ੍ਹਾਂ ਦੀ ਸਰਕਾਰੀ ਨੌਕਰੀਆਂ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜੇਕਰ ਅਸੀਂ ਸਰਕਾਰੀ ਸਹੂਲਤਾਂ ਦੀ ਜਾਣਕਾਰੀ ਲੈਂਦੇ ਹਾਂ ਤਾਂ ਸਾਨੂੰ ਸੇਵਾ ਕੇਂਦਰ ਵਿੱਚੋਂ ਉਸ ਦੀ ਜਾਣਕਾਰੀ ਮਿਲਦੀ ਹੈ ਸੇਵਾ ਕੇਂਦਰ ਵਿੱਚ ਜਿਵੇਂ ਕਿ ਅਸੀਂ ਆਧਾਰ ਕਾਡ ਅਪਲਾਈ ਕਰਦੇ ਹਾਂ ਤਾਂ ਸਾਨੂੰ ਆਧਾਰ ਕਾਰਡ ਬਾਰੇ ਕਈ ਅਪਡੇਟਸ ਮਿਲਦੀਆਂ ਹਨ ਜਿਵੇਂ ਕਿ ਅਸੀਂ ਪੈਨ ਕਾਰਡ ਈਸ਼ਰਮ ਕਾਰਡ ਆਦਿ ਤਰ੍ਹਾਂ ਦੇ ਕਾਰਡ ਬਣਾਉਣੇ ਹੈ ਤਾਂ ਸਾਨੂੰ ਉੱਥੋਂ ਕਈ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਹੋਵੇਗੀ ਸੇਵਾ ਕੇਂਦਰ ਦੇ ਬਾਹਰ ਕਈ ਤਰ੍ਹਾਂ ਦੀਆਂ ਦੁਕਾਨਾਂ ਹੁੰਦੀਆਂ ਹਨ ਜਿਸ ਵਿੱਚ ਜਾ ਕੇ ਅਸੀਂ ਆਪਣੇ ਪੈਨ ਕਾਰਡ ਈਸ਼ਰਮ ਕਾਰਡ ਆਦਿ ਅਪਲਾਈ ਕਰ ਸਕਦੇ ਹਾਂ ਸਰਕਾਰ ਨੇ ਬਹੁਤ ਹੀ ਤਰ੍ਹਾਂ ਦੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ